ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਮੈਂ ਸੁਰਿੰਦਰ ਸਿੰਘ ਨੇਗੀ ਗੱਲ ਕਰਦਾ ਪਿਆ ਹਾਂ ਸਰ ਮੈਂ ਤੁਹਾਡੀ ਕੰਪਨੀ ਦੇ ਥਰੂ ਇੱਕ ਵਾਰ ਹੈਡਫੋਨ ਮੰਗਵਾਏ ਸੀਗੇ ਮੇਰਾ ਫਸਟ ਐਕਸਪੀਰੀਐਂਸ ਸੀਗਾ ਬੱਟ ਹੈਡਫੋਨ ਬਹੁਤ ਅੱਛੇ ਨਿਕਲੇ ਅਤੇ ਸ ਉਹਦਾ ਸਪੈਸ਼ਿਲੀ ਮੈਨੂੰ ਉਹਦੀ ਜਿਹੜੀ ਪੈਕਿੰਗ ਆ ਔਰ ਜਿਹੜਾ ਉਹਦੇ ਹੈਡਫੋਨ ਦਾ ਸਾਈਜ਼ ਹੈ ਉਹ ਬਿਲਕੁਲ ਬਹੁਤ ਅੱਛਾ ਲੱਗਾ ਉਸ ਮਤਲਬ ਜੋ ਉਹਦੇ ਹੈਡਫੋਨ ਹੈ ਸਾਰਿਆਂ ਨੂੰ ਬਹੁਤ ਪਸੰਦ ਆਏ ਸਪੈਸ਼ਿਲੀ ਮੇਰੇ ਬ੍ਰਦਰ ਨੂੰ ਬਹੁਤ ਪਸੰਦ ਆਏ ਮੇਰੇ ਫਰੈਂਡਸ ਨੂੰ ਬਹੁਤ ਪਸੰਦ ਆਏ ਹੈ ਅਤੇ ਸਭ ਤੋਂ ਵਧੀਆ ਗੱਲ ਹੈਗੀ ਹੈ ਪ੍ਰੋਡਕਟ ਦੀ ਅਤੇ ਉਹਦੇ 'ਚ ਸਾਊਂਡ ਕੁਆਲਿਟੀ ਬਹੁਤ ਅੱਛੀ ਆ ਅਤੇ ਜਿਹੜੇ ਕਰਕੇ ਉਸ ਵੋਇਸ ਦੀ ਕੋਈ ਉਹ ਨਹੀਂ ਆਉਂਦੀ ਅਤੇ ਮਤਲਬ ਵੋਇਸ ਵੀ ਮਿਊਜ਼ਿਕ ਕਈ ਹੈੱਡਫੋਨਸ ਦੇ ਵਿੱਚ ਆਪਾਂ ਯੂਜ ਕਰਦੇ ਹਾਂ ਤਾਂ ਉਨ੍ਹਾਂ ਦੀ ਵੋਇਸ ਕੁਆਲਿਟੀ ਨਹੀਂ ਆਉਂਦੀ ਬੱਟ ਜੋ ਤੁਸੀਂ ਤੁਹਾਡੀ ਕੰਪਨੀ ਦੇ ਥਰੂ ਮੈਂ ਹੈਡਫੋਨ ਮੰਗਵਾਏ ਹੈ ਉਹਦੇ 'ਚ ਵੋਇਸ ਕੁਆਲਿਟੀ ਬਹੁਤ ਅੱਛੀ ਹੈ ਪਿੱਛੇ ਈਵਨ ਕਿ ਜੋ ਸਾਊਂਡਸ ਆਉਂਦਾ ਆ ਉਹ ਵੀ ਕਲੀਅਰ ਸੁਣਦਾ ਇਆ ਅਤੇ ਜਿਹਦੇ ਕਰਕੇ ਮਿਊਜ਼ਿਕ ਸੁਣਨ ਜਾਂ ਟੀ ਵੀ ਸੀਰੀਅਲਸ ਜਾਂ ਵੈੱਬ ਸੀਰੀਜ਼ ਦੇਖਣ ਦਾ ਮਜ਼ਾ ਬਹੁਤ ਆਉਂਦਾ ਆ ਤਾਂ ਸਭ ਤੋਂ ਵਧੀਆ ਗੱਲ ਹੈਗੀ ਹੈ ਕਿ ਇਹਦੀ ਬੈਟਰੀ ਜਿਹੜੀ ਮੈਨੂੰ ਅਸੈਟ ਸੀਗੀ ਕਿ ਦੋ ਤਿੰਨ ਘੰਟੇ ਚੱਲੇਗੀ ਕਿਉਂਕਿ ਮੇਰਾ ਫਰਸਟ ਐਕਸਪੀਰੀਐਂਸ ਸੀਗਾ ਬੱਟ ਇਹਦੀ ਬੈਟਰੀ ਬੈਕ ਅੱਪ ਬਹੁਤ ਅੱਛਾ ਆ ਮੈਂ ਇੱਕ ਵਾਰ ਚਾਰਜ ਕਰਦਾ ਅਤੇ ਪੰਜ ਛੇ ਘੰਟੇ ਅਰਾਮ ਨਾਲ ਮਤਲਬ ਈਜਿਲੀ ਨਿਕਲ ਜਾਂਦੇ ਆ ਅਤੇ ਇਟਸ ਡਿਪੇਂਡ ਓਨ ਮਤਲਬ ਯੂਜ ਕਿ ਕਿੱਦਾਂ ਮੈਂ ਯੂਜ ਕਰਦਾ ਪਿਆ ਬੱਟ ਮੈਨੂੰ ਫ਼ ਆਫ਼ਟਰਆਲ ਮੈਂ ਦੇਖਿਆ ਕਿ ਸਿਕਸ ਸੈਵਨ ਆਰਸ ਇਹਦੇ ਇਜ਼ਿਲੀ ਨਿ ਨਿਕਲ ਜਾਂਦੇ ਹੈ ਜਿਹਦੇ 'ਚ ਕੋਈ ਮਤਲਬ ਪ੍ਰੋਬਲਮ ਨਹੀਂ ਆ ਰਹੀ ਔਰ ਇਜੀ ਟੂ ਕੈਰੀ ਆ ਕਿ ਮੈਂ ਇਹਨੂੰ ਇਜਿਲੀ ਮਤਲਬ ਅਰਾਮ ਨਾਲ ਕੈਰੀ ਕਰ ਸਕਦਾ ਹਾਂ ਔਰ ਜਦੋਂ ਅਗਰ ਡਾਊਨ ਹੁੰਦਾ ਹੈ ਤਾਂ ਮੈਂ ਨਾਲ ਇਹਨੂੰ ਅੰਦਰ ਕਰਕੇ ਚਾਰਜਿੰਗ ਦਾ ਸਿਸਟਮ ਵੀ ਬਹੁਤ ਅੱਛਾ ਹੈ ਜੋ ਇਜ਼ੀ ਔਰ ਜਲਦੀ ਚਾਰਜ ਕਰਦਾ ਆ ਅਤੇ ਮੇਰੇ ਫਰੈਂਡਸ ਨੂੰ ਬਹੁਤ ਪਸੰਦ ਆਇਆ ਅਤੇ ਮੇਰੇ ਫਰੈਂਡਸ ਵੀ ਮੇਰੇ ਤੋਂ ਡਿਮਾਂਡ ਕਰਦੇ ਪਏ ਕਿ ਜਾਂ ਤਾਂ ਸਾਨੂੰ ਇਹ ਵਾਲੇ ਦੇ ਦੇ ਅਤੇ ਜਾਂ ਸਾਡੇ ਵਾਸਤੇ ਨਵੇਂ ਮੰਗਵਾ ਲੈ ਅਤੇ ਮੈਨੂੰ ਮਤਲਬ ਹੈਡਫੋਨ ਇੰਨੇ ਅੱਛੇ ਆਏ ਅਤੇ ਇਹਦੇ 'ਚ ਹੋਰ ਵੀ ਮੈਂ ਦੇਖੇ ਸੀ ਕਲਰਸ ਓਪਸ਼ਨਸ ਵੀ ਬਹੁਤ ਅੱਛੀਆਂ ਨੇ ਕੋਈ ਕੋਈ ਗ੍ਰੀਨ ਕਲਰ ਦਾ ਕੋਈ ਬਲੈਕ ਕਲਰ ਦਾ ਅਤੇ ਔਲ ਕਲਰਸ ਆਰ ਵੈਰੀ ਗੂੱਡ ਸਾਰੇ ਕਲਰਸ ਬਹੁਤ ਅੱਛੇ ਨੇ ਅਤੇ ਮੈਂ ਚਾਹੁੰਦਾ ਹਾਂ ਕਿ ਥੋੜ੍ਹੇ ਜਿਹੇ ਹੋ ਹੋਰ ਮੰਗਾਵਾਂ ਆਪਣੇ ਫਰੈਂਡਸ ਵਾਸਤੇ ਅਤੇ ਜਿਹਦੇ ਕਰਕੇ ਮੈਨੂੰ ਤੁਹਾਡੇ ਹੈੱਡਫੋਨ ਦੀ ਜੋ ਸਾਊਂਡ ਕੁਆਲਿਟੀ ਹੈ ਅੱਛੀ ਲੱਗੀ ਆ